ਹਾਂ ਮੈਂ ਡਾਂਸ ਮੁਕਾਬਲੇ ਵਿੱਚ ਹਿੱਸਾ ਲਿਆ ਹੈ ਇਹ ਅਨੁਭਵ ਮੇਰੇ ਲਈ ਬਹੁਤ ਯਾਦਗਾਰ ਸੀ ਮੇਰਾ ਪਹਿਲਾ ਡਾਂਸ ਮੁਕਾਬਲਾ ਸਕੂਲ ਵਿੱਚ ਹੋਇਆ ਸੀ ਮੈਂ ਭੰਗੜਾ ਡਾਂਸ ਪੇਸ਼ ਕੀਤਾ ਸੀ ਮੈਨੂੰ ਬਹੁਤ ਰੋਚਕ ਲੱਭਿਆ ਸੀ ਅਤੇ ਮੈਂ ਆਪਣਾ ਸਰਬੋਤਮ ਪੇਸ਼ ਕਰਨ ਲਈ ਮਿਹਨਤ ਕੀਤੀ ਸੀ ਮੁਕਾਬਲੇ ਦਿਨ ਦੇ ਦਿਨ ਮੈਂ ਬਹੁਤ ਉਤਸ਼ਾਹਿਤ ਸੀ ਮੈਂ ਆਪਣਾ ਪ੍ਰਦਰਸ਼ਨ ਦਿੱਤਾ ਅਤੇ ਦਰਸ਼ਕਾਂ ਨੇ ਮੇਰਾ ਬਹੁਤ ਸਮਰਥਨ ਦਿੱਤਾ ਮੈਂ ਪਹਿਲਾ ਇਨਾਮ ਜਿੱਤਿਆ ਸੀ